ਡਾਂਸ ਦਾ ਸਾਡੇ ਪਿੰਡ ਵਿੱਚ ਬਹੁਤ ਮਹੱਤਵ ਹੈ ਡਾਂਸ ਹਰ ਖੁਸ਼ੀ ਦੇ ਮੌਕੇ 'ਤੇ ਕੀਤਾ ਜਾਂਦਾ ਹੈ ਜਦੋਂ ਵੀ ਕਿਸੇ ਦੇ ਘਰ ਕੋਈ ਵੀ ਖੁਸ਼ੀ ਆਉਂਦੀ ਹੈ ਤਾਂ ਲੋਕ ਉਸਨੂੰ ਡਾਂਸ ਕਰਕੇ ਪ੍ਰਗਟ ਕਰਦੇ ਹਨ ਡਾਂਸ ਕਰਨ ਨਾਲ ਸਾਡੇ ਸਰੀਰ ਦੀਆਂ ਸਾਰੀਆਂ ਇੰਦਰੀਆਂ ਕੰਮ ਕਰਦੀਆਂ ਹਨ ਅਤੇ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਜਦੋਂ ਵੀ ਕਿਸੇ ਦੇ ਘਰ ਕੋਈ ਵੀ ਖੁਸ਼ੀ ਆਉਂਦੀ ਹੈ ਤਾਂ ਲੋਕ ਉਸ ਖੁਸ਼ੀ ਵਿੱਚ ਨੱਚਦੇ ਟੱਪਦੇ ਝੂੰਮਦੇ ਹਨ ਇਸ ਤਰ੍ਹਾਂ ਸਾਨੂੰ ਡਾਂਸ ਦਾ ਬਹੁਤ ਆਨੰਦ ਆਉਂਦਾ ਹੈ ਜਦੋਂ ਵੀ ਕਿਸੇ ਘਰ ਕੋਈ ਪੁੱਤਰ ਜੰਮਦਾ ਹੈ ਤਾਂ ਲੋਕ ਖੁਸ਼ੀ ਵਿੱਚ ਡੀਜੇ ਲਾ ਕੇ ਨੱਚਦੇ ਹਨ ਜੋ ਲੋਕ ਡਾਂਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਉਹਨਾਂ ਨੂੰ ਵੀ ਖੁਸ਼ੀ ਵਿੱਚ ਉਹਨਾਂ ਦੇ ਵੀ ਪੈਰ ਝੂੰਮਣ ਲੱਗ ਜਾਂਦੇ ਹਨ ਕਿਉਂਕਿ ਡਾਂਸ ਇੱਕ ਹੈ ਹੀ ਇੱਦਾਂ ਦੀ ਚੀਜ਼ ਜਿਸ ਨੂੰ ਦੇਖ ਕੇ ਹੀ ਸਾਡੀ ਰੂਹ ਖੁਸ਼ ਹੋ ਜਾਂਦੀ ਹੈ ਅਸੀਂ ਕਿਸੇ ਵੀ ਤਿਉਹਾਰ ਨੂੰ ਮਨਾਉਣਾ ਹੋਵੇ ਤਾਂ ਅਸੀਂ ਡਾਂਸ ਹੀ ਕਰਦੇ ਹਾਂ ਡਾਂਸ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਡਾਂਸ ਕਰਨ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਕੋਈ ਵੀ ਬਿਮਾਰੀ ਸਾਡੇ ਨੇੜੇ ਨਹੀਂ ਆਉਂਦੀ ਡਾਂਸ ਹੀ ਸਾਡਾ ਜੀਵਨ ਹੈ ਡਾਂਸ ਕਰਨ ਨਾਲ ਅਸੀਂ ਆਪਣੇ ਦਿਮਾਗ ਨੂੰ ਕਮਾਂਡ ਦਿੰਦੇ ਹਾਂ ਜਿਸ ਨਾਲ ਸਾਡਾ ਦਿਮਾਗ ਸਾਡੀ ਕਮਾਂਡ ਸੁਣ ਕੇ ਸਾਨੂੰ ਉਸੇ ਤਰ੍ਹਾਂ ਹੀ ਨੱਚਣ ਕੁੱਦਣ ਨੂੰ ਕਹਿੰਦਾ ਹੈ ਡਾਂਸ ਹੀ ਸਾਡੇ ਜੀਵਨ ਦਾ ਆਧਾਰ ਹੈ ਡਾਂਸ ਨਾਲ ਹੀ ਜ਼ਿੰਦਗੀ ਹੈ ਧੰਨਵਾਦ